ਪੰਜਾਬ ਦਾ ਭੂਗੋਲ ਰਾਜ ਵਿੱਚ ਖੇਤੀਬਾੜੀ ਅਭਿਆਸਾਂ ਅਤੇ ਫਸਲਾਂ ਦੇ ਉਤਪਾਦਨ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰ ਰਿਹਾ ਹੈ ਜਿਵੇਂ ਕਿ ਹਰ ਸਾਲ ਤਾਪਮਾਨ ਇਕ ਡਿਗਰੀ ਸੈਲਸੀਅਸ ਤੱਕ ਵੱਧ ਰਿਹਾ ਹੈ ਤਾਂ ਗਰਮੀ ਵਧਣ ਨਾਲ ਫਸਲਾਂ ਜਲਦੀ ਪੱਕ ਜਾਂਦੀਆਂ ਹਨ ਪਰ ਦਾਣੇ ਘੱਟ ਹੁੰਦੇ ਹਨ ਇਸੇ ਤਰ੍ਹਾਂ ਸੋਕਾ ਪੈਣ ਜਾਂ ਹੜ ਆਉਣ ਦੀ ਸੰਭਾਵਨਾ ਵੀ ਫਸਲਾਂ ਨੂੰ ਬਰਬਾਦ ਕਰਦੀ ਹੈ